ਸਤਿ ਸ਼੍ਰੀ ਅਕਾਲ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਕਟਰ ਚੌਦਾਂ ਤੋਂ ਗੱਲ ਕਰ ਰਿਹਾ ਹਾਂ ਬਾਈ ਜੀ ਮੈਂ ਆਪਣੇ ਲਈ ਇੱਕ ਰਾਈਡ ਬੁੱਕ ਕਰਵਾਈ ਹੈ ਸੋ ਸੋ ਮੇਰੀ ਨਾ ਗਿਆਰਾਂ ਵਜੇ ਦੀ ਫਲਾਈਟ ਹੈ ਸੋ ਹੁਣ ਦਸ ਵੱਜ ਚੁੱਕੇ ਹਨ ਮੈਂ ਬੇਨਤੀ ਕਰਦਾ ਕਿ ਤੁਸੀਂ ਮੇਰੇ ਕੋਲ ਜਲਦ ਤੋਂ ਜਲਦ ਆ ਜਾਓ ਮੈਂ ਤੁਹਾਡੇ ਰੇਟਿੰਗ ਵੀ ਦੇਖੀ ਹੈ ਕਾਫ਼ੀ ਵਧੀਆ ਲੱਗੀ ਮੈਨੂੰ ਸੋ ਮੈਂ ਬੇਨਤੀ ਕਰਦਾ ਤੁਹਾਡੀ ਰੇਟਿੰਗ ਨੂੰ ਦੇਖ ਕੇ ਕਿ ਤੁਸੀਂ ਮੈਨੂੰ ਸਮੇਂ ਸਿਰ ਆਪਣੀ ਫਲਾਈਟ ਤੱਕ ਪਹੁੰਚਾ ਦਿਓ ਗੇ ਤੋ ਮੈਨੂੰ ਤੁਹਾਡਾ ਟਾਈਮ ਸ਼ੋ ਕਰ ਰਿਹਾ ਹੈ ਪੰਤਾਲੀ ਮਿੰਟ ਤੱਕ ਤਾਂ ਤੁਸੀਂ ਮੈਨੂੰ ਪਹੁੰਚਾ ਦਿਓਗੇ ਪਰ ਹਜੇ ਪੂਰਾ ਸੱਠ ਮਿੰਟ ਪਏ ਹਨ ਸੋ ਜਲਦੀ ਤੋਂ ਜਲਦੀ ਮੇਰੇ ਕੋਲ ਆ ਜਾਓ ਤਾਂ ਜੋ ਮੈਂ ਆਪਣੀ ਫਲਾਈਟ ਨੂੰ ਲੈ ਸਕਾਂ